ਵੈਸੇ ਤਾਂ ਮੇਰੇ ਰੋਲ ਮੌਡਲ ਨਰਿੰਦਰ ਸਿੰਘ ਕਪੂਰ ਹੀ ਹਨ ਜਿਹਨਾਂ ਨੇ ਮੇਰੇ ਕੰਮ ਨੂੰ ਬਹੁਤ ਜ਼ਿਆਦਾ ਹੀ ਪ੍ਰਭਾਵਿਤ ਕੀਤਾ ਹੈ ਅਤੇ ਮੇਰੀ ਬਹੁਤ ਹੀ ਪ੍ਰਸ਼ੰਸਾ ਕੀਤੀ ਹੈ ਅਤੇ ਨਰਿੰਦਰ ਸਿੰਘ ਕਪੂਰ ਦੀ ਆਪਾਂ ਗੱਲ ਕੀਤੀ ਜਾਵੇ ਤਾਂ ਖਿੜਕੀਆਂ ਕਿਤਾਬ ਬਹੁਤ ਹੀ ਪੜ੍ਹਨਯੋਗ ਬਹੁਤ ਅੱਛੀ ਕਿਤਾਬ ਉਹਨਾਂ ਨੇ ਲਿਖੀ ਹੋਈ ਹੈ ਜਿਵੇਂ ਕਿ ਆਪਾਂ ਗੱਲ ਇੱਕ ਹੋਰ ਉਹਨਾਂ ਦੀ ਕਿਤਾਬ ਦੀ ਕਰਾਂਗੇ ਤਰਕਵੇਦ ਇਸ ਕਿਤਾਬ ਦੇ ਵਿੱਚ ਹੀ ਮੈਨੂੰ ਕਿਵੇਂ ਆਪਣੀ ਗੱਲਾਂ ਨੂੰ ਹੋਰ ਵੀ ਜ਼ਿਆਦਾ ਭਾਵ ਪ੍ਰਭਾਵਿਤ ਕਰਨਾ ਹੈ ਉਹ ਸਿਖਾਇਆ ਗਿਆ ਹੈ